ਸਤਿ ਸ਼੍ਰੀ ਅਕਾਲ ਮਾਨਸੀ ਮੈਂ ਆਸ਼ਾ ਕਰਦੀ ਹਾਂ ਕਿ ਤੇਰੀ ਤਬੀਅਤ ਚੰਗੀ ਹੋਵੇਗੀ ਅਤੇ ਤੇਰੇ ਮਾਤਾ ਪਿਤਾ ਅਤੇ ਭਰਾ ਵੀ ਬਹੁਤ ਹੀ ਚੰਗੇ ਹਾਲਾਤਾਂ ਵਿੱਚ ਹੋਣਗੇ ਮੈਂ ਅਤੇ ਮੇਰਾ ਪਰਿਵਾਰ ਵੀ ਇੱਥੇ ਸੁਖੀ ਹਾਂ ਅਤੇ ਹੁਣ ਗਰਮੀਆਂ ਦੀ ਛੁੱਟੀਆਂ ਕਰਕੇ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਾਂ ਮੈਂ ਇਸ ਵਾਰ ਸੋਚਿਆ ਹੈ ਕਿ ਦਾਦੀ ਜੀ ਨਾਲ ਕਿਸੇ ਤੀਰਥ ਸਥਾਨ ਦੀ ਯਾਤਰਾ ਕਰਾਂ ਔਰ ਇਸ ਲਈ ਇੱਕ ਉਬਰ ਜਾਂ ਓਲਾ ਬੁੱਕ ਓ ਓਲਾ ਦੀ ਵਰਤੋਂ ਕਰਨ ਦੀ ਸੋਚ ਰਹੇ ਹਾਂ ਮੈਨੂੰ ਪਤਾ ਹੈ ਕਿ ਤੂੰ ਅਕਸਰ ਬਾਹਰ ਜਾਉਣ ਲਈ ਓਲਾ ਦੀ ਵਰਤੋਂ ਕਰਦੀ ਹੈ ਇਸ ਲਈ ਮੈਂ ਇਸ ਬਾਰੇ ਤੇਰੇ ਤੋਂ ਗਿਆਨ ਲੈਣਾ ਚਾਹੁੰਦੀ ਹਾਂ ਮੈਨੂੰ ਪਤਾ ਹੈ ਕਿ ਤੈਨੂੰ ਇਸ ਬਾਰੇ ਵਧੇਰੇ ਗਿਆਨ ਹੈ ਇਸ ਲਈ ਮੈਂ ਤੈਨੂੰ ਇਸ ਬਾਰੇ ਪੁੱਛ ਰਹੀ ਹਾਂ ਜਿੱਦਾਂ ਕਿ ਤੈਨੂੰ ਪਤਾ ਹੀ ਹੈ ਕਿ ਬਾਹਰ ਗੇਤਿਆ ਕਿਸੇ ਵੀ ਵਿਅਕਤੀ ਨਾਲ ਰਹਿਣਾ ਔਖਾ ਹੁੰਦਾ ਹੈ ਇਸੇ ਲਈ ਇੱਕ ਭਰੋਸੇਮੰਦ ਡਰਾਈਵਰ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਦੀ ਇੱਕ ਚੰਗੀ ਰੇਟਿੰਗ ਅਤੇ ਫੀਡਬੈਕ ਹੋਵੇ ਤੈਨੂੰ ਤਾਂ ਪਤਾ ਹੀ ਹੈ ਦਾਦੀ ਜੀ ਹੁਣ ਥੋੜ੍ਹੇ ਬੁੱਢੇ ਹੋ ਚੁੱਕੇ ਹਨ ਅਤੇ ਇਸ ਲਈ ਉਹਨਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਅਤੇ ਕਿਸੇ ਐਸੇ ਡਰਾਈਵਰ ਬਾਰੇ ਦੱਸਿਓ ਜਿਸ ਨਾਲ ਸਾਨੂੰ ਕਿਸੇ ਚੀਜ਼ ਦਾ ਡਰ ਨਾ ਹੋਵੇ ਇਸ ਲਈ ਤੇਰੇ ਗਿਆਨ ਦੇ ਅਨੁਸਾਰ ਉਬਰ ਸਰਵਿਸਸ ਕੰਪਨੀ ਬਾਰੇ ਸੋਚ ਰਹੀਂ ਹਾਂ ਇਸ ਦਾ ਇੱਕ ਡਰਾਈਵਰ ਮਨੋਜ ਕੁਮਾਰ ਜਿਸ ਦੀ ਉਮਰ ਸੈਂਤੀ ਕੁ ਸਾਲ ਹੈ ਉਹ ਇੱਕ ਚੰਗਾ ਡਰਾਈਵਰ ਹੈ ਅੱਜ ਤੱਕ ਉਸ ਨਾਲ ਕੋਈ ਵੀ ਅਜਿਹਾ ਕੇਸ ਨਾ ਹੋਇਆ ਜਿਸ ਦੀ ਉਸਨੂੰ ਭੁਗਤਾਨ ਕਰਨੀ ਪਵੇ ਮਨੋਜ ਦੀ ਰੇਟਿੰਗ ਵੀ ਵਧੀਆ ਹੈ ਅਤੇ ਉਸਨੂੰ ਕਈ ਚੰਗੇ ਚੰਗੇ ਫੀਡਬੈਕ ਵੀ ਮਿਲੇ ਹਨ ਮਨੋਜ ਨਾਲ ਗੱਲਬਾਤ ਕਰਕੇ ਮੈਂ ਉਸ ਬਾਰੇ ਥੋੜ੍ਹਾ ਪਤਾ ਵੀ ਕੀਤਾ ਹੈ ਮਨੋਜ ਦੀ ਗੱਡੀ ਸਵਿਫਟ ਡਿਜ਼ਾਇਰ ਹੈ ਜਿਸ ਵਿੱਚ ਮੈਂ ਅਤੇ ਦਾਦੀ ਜੀ ਆਰਾਮਦਾਇਕ ਸੀਟਾਂ ਦਾ ਲੁਪਤ ਉਠਾ ਕੇ ਕਿਤੇ ਵੀ ਯਾਤਰਾ ਕਰ ਸਕਦੇ ਹਾਂ ਮੈਨੂੰ ਉਹ ਗੱਡੀ ਅਤੇ ਡ੍ਰਾਈਵਰ ਕਾਫੀ ਚੰਗੇ ਲੱਗੇ ਹਨ ਵੈਸੇ ਵੀ ਉਬਰ ਕੰਪਨੀ ਬਾਰੇ ਬਹੁਤ ਸੁਣਿਆ ਹੈ ਕਿ ਉਹ ਇੱਕ ਚੰਗੀ ਕੰਪਨੀ ਹੈ ਨਾਲੇ ਮੈਨੂੰ ਆਸ਼ਾ ਹੈ ਕਿ ਜੋ ਗਿਆਨ ਤੂੰ ਮੈਨੂੰ ਦਿੱਤਾ ਹੈ ਉਹ ਚੰਗਾ ਹੀ ਹੋਵੇਗਾ ਤੂੰ ਅਕਸਰ ਬਾਹਰ ਅੰਦਰ ਜਾਣ ਲਈ ਉਹਦਾ ਹੀ ਇਸਤੇਮਾਲ ਕਰਦੀ ਹੈ ਇਸ ਲਈ ਤੈਨੂੰ ਇਸ ਗੱਲ ਦਾ ਜ਼ਿਆਦਾ ਪਤਾ ਹੋਵੇਗਾ ਮੈਂ ਤੇਰੇ ਲਈ ਕੁਛ ਲੈ ਕੇ ਆਉਣ ਦਾ ਵੀ ਸੋਚਿਆ ਹੈ ਜੇ ਉਹ ਮੇਰੀ ਗੱਲ ਮੰਨ ਕੇ ਦੁਕਾਨਾਂ 'ਤੇ ਰੋਕ ਦੇਵੇਗਾ ਤਾਂ ਇਸ ਤੋਂ ਚੰਗਾ ਕੀ ਹੋਵੇਗਾ ਇਸ ਲਈ ਮੈਂ ਉਸ ਨਾਲ ਪਹਿਲਾਂ ਹੀ ਇਸ ਬਾਰੇ ਗੱਲ ਕਰ ਲਈ ਹੈ ਅਜਿਹੀ ਕੰਪਨੀ ਨਾਲ ਜੁੜਨਾ ਇੱਕ ਚੰਗੀ ਗੱਲ ਹੈ ਜਿੱਥੇ ਤੁਸੀਂ ਆਰਾਮਦਾਇਕ ਮਾਹੌਲ ਵਿੱਚ ਰਹਿ ਸਕੋ ਇਸ ਲਈ ਮੈਂ ਤੇਰਾ ਧੰਨਵਾਦ ਕਰਦੀ ਹਾਂ ਕਿ ਇਸ ਇਸ ਖਾਸ ਸੇਵਾ ਇੱਕ ਇਸ ਖਾਸ ਕੈਬ ਸੇਵਾ ਬਾਰੇ ਤੂੰ ਮੈਨੂੰ ਦੱਸਿਆ ਜਿਸ ਦੀ ਰੇਟਿੰਗ ਪੰਜ ਤਾਰਾ ਹੈ ਅਤੇ ਫੀਡਬੈਕ ਬਹੁਤ ਚੰਗੇ ਹਨ ਮਨੋਜ ਵੀ ਇੱਕ ਚੰਗਾ ਵਿਅਕਤੀ ਲੱਗਾ ਹੈ ਉਸ ਦਾ ਮੋਬਾਇਲ ਨੰਬਰ ਮੇਰੇ ਕੋਲ ਹੈ ਔਰ ਮੈਂ ਉਸ ਨਾਲ ਗੱਲ ਵੀ ਕਰ ਲਈ ਹੈ ਥੋੜ੍ਹੇ ਦਿਨਾਂ ਤੱਕ ਆਪਾਂ ਉਸ ਨਾਲ ਕਿਸੇ ਤੀਰਥ ਸਥਾਨ 'ਤੇ ਚੱਲ ਜਾਵਾਂਗੇ ਔਰ ਇਸ ਵਿੱਚ ਤੇਰਾ ਬਹੁਤ ਯੋਗਦਾਨ ਰਿਹਾ ਹੈ ਇਸ ਲਈ ਮੈਂ ਤੈਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ ਚਲ ਠੀਕ ਹੈ ਫਿਰ ਹੁਣ ਆ ਕੇ ਹੀ ਮਿਲਾਂਗੇ ਆਸ਼ਾ ਕਰਦੀ ਹਾਂ ਕਿ ਛੁੱਟੀਆਂ ਤੋਂ ਬਾਅਦ ਆਪਾਂ ਜਲਦ ਮਿਲਾਂ ਮਿਲਣ ਤਾਂ ਕਿ ਮੈਂ ਇਸ ਡਰਾਈਵਰ ਦੀ ਰੇਟਿੰਗ ਦੀ ਜਾਂਚ ਕਰਦਿਆਂ ਹੋਇਆਂ ਦੱਸਾਂ ਕਿ ਇਹ ਕਿਸ ਹੱਦ ਤੱਕ ਸਹੀ ਹੈ ਅਤੇ ਉਬਰ ਕੰਪਨੀ ਦੀ ਸੱਚਾਈ ਵੀ ਪਤਾ ਕਰ ਸਕਾਂ ਹਾਲਾਂਕਿ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਇਹ ਸਭ ਸਾਡੇ ਇਹ ਸਭ ਸਾਡੇ ਨਾਲ ਚੰਗਾ ਹੀ ਹੋਵੇਗਾ ਔਰ ਮੈਂ ਤੇਰਾ ਇਸ ਲਈ ਬਹੁਤ ਧੰਨਵਾਦ ਕਰਦੀ ਹਾਂ